ਮੈਂ ਪਲੱਸ ਟੂ ਤੱਕ ਪੜ੍ਹੀ ਹਾਂ ਪੰਜਾਬੀ ਸਕੂਲ ਮੁਕਤਸਰ ਕੰਨਿਆ ਸਕੂਲ ਤੋਂ ਪਹਿਲੇ ਮੈਂ ਟੈਗੋਰ ਮਿਡਲ ਸਕੂਲ 'ਚ ਪੜ੍ਹਦੀ ਸੀ ਜਿੱਥੇ ਤੱਕ ਮੈਂ ਟੈਂਨਥਕ ਪੜ੍ਹੀ ਉਸ ਤੋਂ ਬਾਅਦ ਮੈਂ ਪਲੱਸ ਵਨ ਟੂ ਸਰਕਾਰੀ ਸਕੂਲ 'ਚ ਕਰੀ ਗਰਲ ਸਕੂਲ ਸੀ ਬਹੁਤ ਅੱਛਾ ਸਕੂਲ ਸੀ ਉੱਥੋਂ ਦੇ ਸਰ ਪ੍ਰਿੰਸੀਪਲ ਬਹੁਤ ਅੱਛੇ ਸੀ ਉੱਥੇ ਬਹੁਤ ਐਕਟੀਵਿਟੀਆਂ ਹੁੰਦੀਆਂ ਸੀ ਜਿਸ ਤਰ੍ਹਾਂ ਡਾਂਸਿੰਗ ਔਰ ਪਲੇਅ ਵਗੈਰਾ ਤਾਂ ਮੈਂ ਡਾਂਸ 'ਚ ਕਾਫੀ ਹਿੱਸਾ ਲੈਂਦੀ ਸੀ ਉਸ ਤੋਂ ਇਲਾਵਾ ਮੈਂ ਗੇਮਸ 'ਚ ਵੀ ਹਿੱਸਾ ਲੈਂਦੀ ਸੀ ਪੜ੍ਹਾਈ ਵਿੱਚ ਵੀ ਠੀਕ ਸੀ ਪੜ੍ਹਨ 'ਚ ਔਰ ਆਪਣੀ ਫਰੈਂਡਸ ਨਾਲ ਕਾਫੀ ਅੱਛਾ ਟਾਈਮ ਸਪੈਂਡ ਕਰਿਆ ਸਕੂਲ ਕਾਫੀ ਦੂਰ ਸੀ ਘਰ ਤੋਂ ਅਸੀਂ ਚੱਲ ਕੇ ਜਾਂਦੀਆਂ ਸੀ ਜ਼ਿਆਦਾਤਰ ਔਰ ਰਸਤੇ 'ਚ ਕਾਫੀ ਮਾਰਕੀਟ ਵਗੈਰਾ ਵੀ ਆਉਂਦੀ ਸੀ ਨੌਕਰੀ ਮੈਂ ਨੌਕਰੀ ਨਹੀਂ ਮੈਂ ਹਾਊਸ ਵਾਈਫ ਹਾਂ ਔਰ ਮੈਂ ਆਪਣੇ ਘਰ 'ਚ ਮਤਲਬ ਆਪਣੇ ਘਰ 'ਚ ਹੀ ਕੰਮ ਕਰਦੀ ਹਾਂ ਮੈਂ ਨੌਕਰੀ ਨਹੀਂ ਕਰਦੀ